ਪੰਜਾਬ ਦੀਆਂ ਬਹੁਤ ਸਾਰੀਆਂ ਪ੍ਰਮੁੱਖ ਕਾਰੋਬਾਰੀ ਸਫਲਤਾ ਦੀਆਂ ਕਹਾਣੀਆਂ ਬਹੁਤ ਹੀ ਜਾਣੀਆਂ ਜਾਂਦੀਆਂ ਹਨ ਇਸੇ ਤੌਰ 'ਤੇ ਇੱਕ ਕਹਾਣੀ ਹੈ ਪ ਪੰਜਾਬ ਦੇ ਦੋ ਬੰਦੇ ਸੀਗੇ ਜਿਹਨਾਂ ਨੇ ਗੁੜ ਦਾ ਸਟਾਰਟਅਪ ਸ਼ੁਰੂ ਕੀਤਾ ਸੀ ਇੱਕ ਬੰਦਾ ਜਿਹਦਾ ਨਾਮ ਅਮਰਿੰਦਰ ਸਿੰਘ ਜਿਮੀਦਾਰ ਉਹਨੇ ਗੁਰੂ ਨਾਨਕ ਐਂਟਰਪ੍ਰਾਈਜ਼ਸ ਦੇ ਨਾਮ ਦੇ ਥੱਲੇ ਅਤੇ ਦੂਜਾ ਬੰਦਾ ਜਿਹਦਾ ਨਾਮ ਨਵਨੂਰ ਅਤੇ ਕੌਸ਼ਨ ਉਹਨਾਂ ਨੇ ਜਾਗਰ ਕੈਨ ਬਲਕਿ ਗੁੜ ਨੂੰ ਗੁੜ ਦੀ ਇੰਡਸਟਰੀ ਨੂੰ ਇੰਨੇ ਵੱਡੇ ਲੈਵਲ 'ਤੇ ਲੈ ਕੇ ਗਏ ਹੁਣ ਉਹ ਇੰਟਰਨੈਸ਼ਨਲ ਲੈਵਲ 'ਤੇ ਜਾਣੇ ਜਾਂਦੇ ਹਨ ਆ ਜੋ ਕਿ ਅਮਰਿੰਦਰ ਸਿੰਘ ਜੋ ਕਿ ਇੰਨੇ ਲੋਨ ਵਿੱਚ ਸੀਗਾ ਉਹ ਇਕ ਇਰਨੋਟੀਕਲ ਇੰਜੀਨੀਅਰ ਸੀਗਾ ਹੁਸ਼ਿਆਰਪੁਰ ਪੰਜਾਬ ਉਹ ਸਾਰੀਆਂ ਉਮੀਦਾਂ ਛੱਡ ਚੁੱਕਾ ਸੀ ਅਤੇ ਈਵਨ ਆਪਣੀ ਜਾਨ ਦੇਣ ਦਾ ਵੀ ਸੋਚਿਆ ਸੀ ਉਹਨੇ ਪਰ ਉਹਨੇ ਉਮੀਦ ਨਾ ਹਾਰੀ ਅਤੇ ਪੰਜਾਬ ਨੂੰ ਅੰ ਅੱਗੇ ਲਾਉਣ ਦੀ ਜ਼ਿੱਦ ਵਿੱਚ ਉਹਨੇ ਇਹ ਗੁੜ ਦਾ ਕਾਰੋਬਾਰ ਕੀਤਾ ਅਤੇ ਉਹ ਇਸ ਨੂੰ ਇੰਟਰਨੈਸ਼ਨਲ ਲੈਵਲ 'ਤੇ ਲੈ ਕੇ ਗਿਆ ਹੁਣ ਉਸ ਦਾ ਕਾਰੋਬਾਰ ਲੱਖਾਂ ਕਰੋੜਾਂ ਦਾ ਪ੍ਰੋਫਿਟ ਕਮਾਉਂਦਾ ਹੈ